ਗਿੱਧੇ ਦਾ ਕੀ ਮਹੱਤਵ ਹੈ ਅੱਜ ਦੇ ਗਿੱਧੇ ਅਤੇ ਪਹਿਲਾਂ ਦੀ ਗਿੱਧੇ ਵਿੱਚ ਕੀ ਫਰਕ ਹੈ ਗਿੱਧਾ ਕੁੜੀਆਂ ਲਈ ਹਰਮਨ ਪਿਆਰਾ ਨਾਚ ਹੈ ਇਸ ਦੇ ਵਿੱਚ ਇਸਤਰੀਆਂ ਆਪਣੇ ਹਾਵ ਭਾਵਾਂ ਨੂੰ ਖੁਸ਼ੀ ਨੂੰ ਪ੍ਰਗਟ ਕਰਦੀਆਂ ਹਨ ਗਿੱਧਾ ਜਿਹੜਾ ਕਿ ਇੱਕ ਤਾੜੀ ਨਾਚ ਹੈ ਇਸਦੇ ਵਿੱਚ ਕੁੜੀਆਂ ਇੱਕ ਘੋ ਘੇਰੇ ਦੇ ਵਿੱਚ ਖੜ ਜਾਂਦੀਆਂ ਹਨ ਅਤੇ ਤਾੜੀ ਮਾਰਦੀਆਂ ਹਨ ਤਾੜੀ ਮਾਰਦਿਆਂ ਹੋਏ ਉਹ ਅ ਇੱਕ ਬੋਲੀ ਉਚਾਰਦੀਆਂ ਹਨ ਜੋ ਕਿ ਉਹਨਾਂ ਦੇ ਹਾਫ ਭਾਵਾਂ ਨੂੰ ਪ੍ਰਗਟ ਕਰਦੀ ਹੈ ਉਹ ਬੋਲੀ ਦੇ ਨਾਲ ਨਾਲ ਤਾੜੀ ਮਾਰਦੀਆਂ ਹਨ ਅਤੇ ਬੋਲੀ ਨੂੰ ਉੱਚੀ ਅਵਾਜ਼ ਦੇ ਵਿੱਚ ਹੋਰ ਚੱਕਦੀਆਂ ਹਨ ਜਿਹੜੇ ਅੱਗੋਂ ਘੇਰੇ ਦੇ ਵਿੱਚੋਂ ਦੋ ਕੁੜੀਆਂ ਅੱਗੇ ਆਣ ਕੇ ਉਸਨੂੰ ਗਿੱਧਾ ਪਾਉਂਦੀਆਂ ਤਾੜੀ ਮਾਰਦੀਆਂ ਅਤੇ ਤਾੜੀ ਦੇ ਨਾਲ ਹੀ ਢੋਲਕੀ ਦੀ ਤਾਲ ਮੈਚ ਕਰਦੀਆਂ ਜਦੋਂ ਉਹ ਤਾੜੀ ਢੋਲਕੀ ਦੇ ਨਾਲ ਮੈਚ ਕਰਦੀ ਤਾਂ ਜਿਹੜੀ ਉਸ ਦੇ ਵਿੱਚੋਂ ਆਵਾਜ਼ ਆਉਂਦੀ ਤਾਂ ਉਹ ਬਹੁਤ ਹੀ ਸੁੰਦਰ ਅਤੇ ਆਨੰਦਮਈ ਹੁੰਦੀ ਹੈ ਇਸ ਤੋਂ ਇਲਾਵਾ ਜੇ ਦੇਖੀਏ ਅਸੀਂ ਤਾਂ ਗਿੱਧਾ ਜਿਹੜਾ ਉਹ ਪਹਿਲਾਂ ਬੀਬੀਆਂ ਦੁਆਰਾ ਕੁੜੀਆਂ ਦੁਆਰਾ ਪਾਇਆ ਜਾਂਦਾ ਸੀ ਪਰ ਅੱਜ ਕੱਲ੍ਹ ਦੇ ਵਿੱ ਗਿੱਧੇ ਦੇ ਵਿੱਚ ਵੇਖੀਏ ਤਾਂ ਜਿਹੜਾ ਇਹ ਗਿੱਧਾ ਉਹ ਮੁੰਡਿਆਂ ਦੁਆਰਾ ਵੀ ਪਾਇਆ ਜਾਣ ਲੱਗ ਪਿਆ ਹੈ ਪੁਰਾਣੇ ਜਮਾਨੇ ਦੇ ਗਿੱਧੇ ਦੇ ਵਿੱਚ ਬੀਬੀਆਂ ਕੋਈ ਵੀ ਖੁਸ਼ੀ ਦੇ ਮੌਕੇ ਦੇ ਉੱਤੇ ਗਿੱਧਾ ਪਾ ਲੈਂਦੀਆਂ ਸਨ ਤਾਂ ਜੋ ਆਪਣੀ ਖੁਸ਼ੀ ਨੂੰ ਪ੍ਰਗਟ ਕਰ ਸਕਣ ਪਰ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਿਹੜਾ ਗਿੱਧਾ ਹੈ ਉਹ ਨਾ ਨਾ ਪਾਇਆ ਜਾਂਦਾ ਹੈ ਜਦੋਂ ਉਹਦੀ ਥਾਂ 'ਤੇ ਡੀ ਜੇ ਲਗਾ ਕੇ ਉਹਦੇ 'ਤੇ ਨੱਚ ਲਿਆ ਜਾਂਦਾ ਹੈ ਗਿੱਧਾ ਤਾਂ ਬਹੁਤ ਹੀ ਘੱਟ ਪਾਇਆ ਜਾਂਦਾ ਹੈ ਜਿਹੜੀਆਂ ਪੁਰਾਣੀਆਂ ਬੀਬੀਆਂ ਉਹ ਕੁੜੀਆਂ ਨੂੰ ਕਹਿ ਕੇ ਗਿੱਧਾ ਤਾਂ ਪਵਾ ਲੈਂਦੀਆਂ ਪਰ ਉਹਨਾਂ ਨੂੰ ਨਾ ਤਾਂ ਬੋਲੀ ਪਾਉਣੀ ਆਉਂਦੀ ਹੈ ਨਾ ਹੀ ਉਹਨਾਂ ਨੂੰ ਤਾੜੀ ਮਾਰਨੀ ਆਉਂਦੀ ਹੈ ਨਾ ਹੀ ਉਹਨਾਂ ਨੂੰ ਢੋਲਕੀ ਦੇ ਨਾਲ ਆਪਣੀ ਜਿਹੜੀ ਤਾੜੀ ਹੈ ਉਹ ਮੈਚ ਕਰਨੀ ਆਉਂਦੀ ਹੈ ਜੇਕਰ ਕੋਈ ਬੀਬੀ ਬੋਲੀ ਪਾ ਵੀ ਦਿੰਦੀ ਹੈ ਤਾਂ ਉਹਨਾਂ ਨੂੰ ਇਹ ਜਿਹੜੀ ਬੋਲੀ ਹੈ ਨਾ ਹੀ ਢੋਲਕੀ ਦੀ ਤਾਲ 'ਤੇ ਚੱਕਣੀ ਆਉਂਦੀ ਹੈ ਨਾ ਹੀ ਤਾੜੀ ਦੀ ਤਾਲ 'ਤੇ ਚੱਕਣੀ ਆਂਉਂਦੀ ਹੈ ਤਾਂ ਇਸ ਵਿੱਚ ਅਸੀਂ ਫਰਕ ਦੇਖ ਸਕਦੇ ਹਾਂ ਕਿ ਪੁਰਾਣੇ ਜਮਾਨੇ ਦੀਆਂ ਬੀਬੀਆਂ ਕੁੜੀਆੰ ਨੂੰ ਜਿਹੜੀ ਬੋਲੀ ਹੈ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਚੱਕਣੀ ਆਉਂਦੀ ਸੀ ਬਹੁਤ ਹੀ ਵਧੀਆ ਉਹ ਵੀ ਜਿਹੜੇ ਗਿੱਧਾ ਪਾ ਲੈਂਦੀਆਂ ਸਨ ਕੁੜੀਆਂ ਵੀ ਅਤੇ ਬੀਬੀਆਂ ਵੀ ਪਰ ਅੱਜ ਕੱਲ੍ਹ ਦੇ ਜਮਾਨੇ ਦੇ ਅਸੀਂ ਵੇਖੀਏ ਤਾਂ ਨਾ ਹੀ ਕੁੜੀਆਂ ਵੀ ਇੰਨਾ ਗਿੱਧੇ ਦੇ ਵਿੱਚ ਪਾਰਟੀਸਪੇਟ ਕਰਦੀਆਂ ਹਨ ਅਤੇ ਨਾ ਹੀ ਉਹਨਾਂ ਦੇ ਘਰਦਿਆਂ ਦੁਆਰਾ ਉਹਨੂੰ ਉਹਨਾਂ ਨੂੰ ਕਿਹਾ ਜਾਂਦਾ ਹੈ ਵੀ ਤੁਸੀਂ ਜਿਹੜਾ ਤੁਹਾਡਾ ਪ੍ਰਸਿੱਧ ਲੋਕ ਨਾਚ ਗਿੱਧਾ ਜਾਂ ਭੰਗੜਾ ਹੈ ਇਸ ਦੇ ਵਿੱਚ ਇਸ ਦੇ ਵਿੱਚ ਤੁਸੀਂ ਆਪਣਾ ਵ ਹੁਨਰ ਦਿਖਾਓ ਤਾਂ ਜੋ ਕਿ ਤੁਹਾਨੂੰ ਵੱਧ ਤੋਂ ਵੱਧ ਬੋਲੀਆਂ ਆ ਸਕਣ ਵੱਧ ਤੋਂ ਵੱਧ ਤੁਸੀਂ ਗਿੱਧਾ ਪਾ ਸਕੋ ਪਰ ਅੱਜ ਕੱਲ੍ਹ ਅਸੀਂ ਕੋਈ ਵੇਖਦੇ ਹਾਂ ਕੋਈ ਦਸ ਪ੍ਰਸੈਂਟ ਹੀ ਕੁੜੀਆਂ ਹੁੰਦੀਆਂ ਹਨ ਜਿਹਨਾਂ ਨੂੰ ਗਿੱਧੇ ਦੇ ਵਿੱਤ ਵਿੱਚ ਇੰਟਰਸਟ ਹੁੰਦਾ ਹੈ ਉਹ ਗਿੱਧੇ ਨੂੰ ਬਰੀਕੀ ਦੇ ਨਾਲ ਸਿੱਖਦੀਆਂ ਹਨ ਉਹ ਪੁਰਾਣੇ ਜਮਾਨੇ ਦੀਆਂ ਬੀਬੀਆਂ ਕੋਲ ਬਹਿ ਕੇ ਗਿੱਧੇ ਬਾਰੇ ਸਿੱਖ ਰਹੀਆਂ ਹਨ ਗਿੱਧਾ ਕਿਵੇਂ ਪਾਇਆ ਜਾਂਦਾ ਹੈ ਗਿੱਧੇ ਦੀ ਤਾੜੀ ਕਿਵੇਂ ਚੱਕੀ ਜਾਂਦੀ ਹੈ ਗਿੱਧੇ ਦੀ ਜਿਹੜੀ ਤਾੜੀ ਦੀ ਤਾਲ ਹੈ ਢੋਲਕੀ ਦੀ ਤਾਲ ਨਾਲ ਕਿਵੇਂ ਮਿਲਾਈ ਜਾਵੇ ਤਾਂ ਉਹ ਉਹਨਾਂ ਕੋਲ ਬੈਠ ਕੇ ਸਿੱਖਦੀਆਂ ਉਹਨਾਂ ਕੋਲੋਂ ਬੋਲੀਆਂ ਸਿੱਖਦੀਆਂ ਅਤੇ ਗਿੱਧੇ ਦੇ ਜਿਹੜੇ ਵੱਖਰੇ ਵੱਖਰੇ ਅਤੇ ਨਵੇਂ ਨਵੇਂ ਤਰੀਕੇ ਢੰਗ ਉਹ ਸਾਰੇ ਪੁਰਾਣੀਆਂ ਜਮਾਨੇ ਦੀਆਂ ਬੀਬੀਆਂ ਦੇ ਕੋਲ ਬਹਿ ਕੇ ਸਿੱਖ ਲੈਂਦੀਆਂ ਹਨ ਇਸ ਦੇ ਨਾਲ ਹੀ ਆਪਾਂ ਵੇਖ ਸਕਦੇ ਹਾਂ ਕਿ ਬਹੁਤ ਜ਼ਿਆਦਾ ਫਰਕ ਆ ਗਿਆ ਹੈ ਅੱਜ ਦੇ ਗਿੱਧੇ ਦੇ ਵਿੱਚ ਅ ਤੋਂ ਪੁਰਾਣੇ ਜਮਾਨੇ ਦੀ ਗਿੱਧੇ ਦੇ ਤੋਂ ਲੈ ਕੇ ਜਿਹੜਾ ਪੁਰਾਣੇ ਜਮਾਨੇ ਦਾ ਗਿੱਧਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਾਇਆ ਜਾਂਦਾ ਸੀ ਪਰ ਅੱਜ ਕੱਲ੍ਹ ਦਾ ਜਿਹੜਾ ਗਿੱਧਾ ਉਹ ਬਹੁਤ ਹੀ ਇੰਨਾ ਵਧੀਆ ਨਹੀਂ ਪਾਇਆ ਜਾਂਦਾ ਨਾ ਹੀ ਕੁੜੀਆਂ ਇਹਦੇ ਵਿੱਚ ਪਾਰਟੀਸਪੇਟ ਕਰਦੀਆਂ ਹਨ ਅਤੇ ਨਾ ਹੀ ਉਹਨਾਂ ਨੂੰ ਕਿਹਾ ਜਾਂਦਾ ਹੈ